ਹਾਂਜੀ ਦੁਨੀਆ ਵਿੱਚ ਕਿਤੇ ਦੀ ਵੀ ਯਾਤਰਾ ਦੇ ਬਾਰੇ ਕਿ ਨਨਕਾਣਾ ਸਾਹਿਬ ਦੀ ਯਾਤਰਾ ਕਰਾਂਗੇ ਉੱਥੇ ਜਾਵਾਂਗੇ ਅਤੇ ਦੇਖਾਂਗੇ ਕਿ ਜਿਹੜਾ ਸਾਡੇ ਤੋਂ ਵਿਛੜ ਗਿਆ ਹੈ ਪਿਛੋਕੜ ਸਾਡਾ ਪਿੱਛੇ ਰਹਿ ਗਿਆ ਉਹਦੇ ਬਾਰੇ ਦੇਖਾਂਗੇ ਅਤੇ ਆਪਣੇ ਗੁਰੂ ਦੀ ਨਗਰੀ ਵੀ ਜਿੱਥੇ ਸਾਡੇ ਗੁਰੂ ਜੀ ਨੇ ਅਵਤਾਰ ਲਿਆ ਅਤੇ ਉਹ ਉੱਥੇ ਰਹੇ ਹੈ ਉਹ ਕਿਵੇਂ ਦੀ ਧਰਤੀ ਹੈ ਉਹਦੇ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ